ਜਦੋਂ ਮੈਂ ਆਪਣੇ ਬਗੀਚੇ ਦੀ ਸਾਂਭ ਸੰਭਾਲ ਕਰਦੀ ਹਾਂ ਮੈਨੂੰ ਕਈ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਪੱਤਿਆਂ 'ਚ ਤੇਲਾ ਪੈ ਜਾਂਦਾ ਹੈ ਖਾਦ ਵਿੱਚ ਸਿਉਂਕ ਪੈ ਜਾਂਦੀ ਹੈ ਜਾਂ ਪ ਪੱਤੇ ਖਰਾਬ ਹੋ ਜਾਂਦੇ ਹਨ ਪੀਲੇ ਪੈ ਜਾਂਦੇ ਹਨ ਜਿਸ ਕਾਰਨ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੁੰਦੀ ਹੈ ਕਿਉਂਕਿ ਜਿਹੜੇ ਪੌਦੇ ਅਸੀਂ ਬੜੇ ਪਿਆਰ ਨਾਲ ਲਗਾਏ ਹੁੰਦੇ ਹਨ ਉਹ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਉਨ੍ਹਾਂ ਦਾ ਜਿਹੜਾ ਜੀਵਨ ਹੈ ਛੇਤੀ ਹੀ ਸਮਾਪਤ ਹੋ ਜਾਂਦਾ ਹੈ ਕਈ ਵਾਰ ਉਨ੍ਹਾਂ ਦੀ ਹੀ ਡੰਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਕਿ ਆਪੇ ਹੀ ਟੁੱਟ ਪੈਂਦੀਆਂ ਹਨ ਅਤੇ ਜਦ ਦੇਖਿਆ ਜਾਵੇ ਤਾਂ ਉਹਦੇ 'ਤੇ ਛੋਟੇ ਛੋਟੇ ਮੱਛਰ ਬੈਠੇ ਹੁੰਦੇ ਆ ਜੋ ਪੌਦਿਆਂ ਦੇ ਪੱਤਿਆਂ ਨੂੰ ਅਤੇ ਟਾਹਣੀਆਂ ਨੂੰ ਖਾ ਰਹੇ ਹੁੰਦੇ ਹਨ